ਖੇਤੀਬਾੜੀ ਦੇ ਜਿਹੜੇ ਸੰਦ ਹਨ ਪਹਿਲਾਂ ਵਾਲੇ ਉਹ ਪਹਿਲੇ ਜ਼ਮਾਨੇ ਦੇ ਮੁਤਾਬਕ ਜਦੋਂ ਕੁਛ ਨਹੀਂ ਸੀਗਾ ਤਾਂ ਉਹ ਵਰਤਣ ਦੇ ਵਿੱਚ ਬਹੁਤ ਸਾਧਨ ਸੌਖੇ ਸੀਗੇ ਬਲਦਾਂ ਨਾਲ ਖੇਤੀ ਹੁੰਦੀ ਸੀ ਊਠਾਂ ਨਾਲ ਖੇਤੀ ਹੁੰਦੀ ਸੀ ਹਲ ਹੁੰਦੇ ਸੀ ਹਲਾਂ ਨਾਲ ਖੇਤੀ ਹੁੰਦੀ ਸੀ ਪਰ ਸਮੇਂ ਦੇ ਮੁਤਾਬਕ ਇਹ ਸਾਰੀਆਂ ਚੀਜ਼ਾਂ ਬਦਲਦੀਆਂ ਗਈਆਂ ਹੁਣ ਖੇਤੀ ਹੈ ਜਿਹੜੀ ਅਗਲੀ ਖੇਤੀ ਨਾਲੋਂ ਬਹੁਤ ਸੌਖੀ ਹੋ ਗਈ ਹੈ ਕਿਉਂਕਿ ਹੁਣ ਟਰੈਕਟਰ ਆ ਗਏ ਅੱਗੇ ਇੱਕ ਹਲ ਮਸਾਂ ਪੰਜ ਛੇ ਕਨਾਲਾਂ ਜ਼ਮੀਨ ਵਾਹੁੰਦਾ ਸੀ ਜਦੋਂ ਕਿ ਹੁਣ ਇੱਕ ਟਰੈਕਟਰ ਆਥਣ ਨੂੰ ਦਸ ਪੰਦਰ੍ਹਾਂ ਵੀਹ ਕਿੱਲੇ ਵਾਹ ਕੇ ਤਿਆਰ ਕਰ ਦਿੰਦਾ ਉਸ ਖੇਤੀ ਦਾ ਅਤੇ ਇਸ ਖੇਤੀ ਦਾ ਬਹੁਤ ਜ਼ਿਆਦਾ ਫਰਕ ਹੈ ਕਿ ਉਹ ਬਲਦਾਂ ਨੇ ਆਪਣੀ ਚਾਲ ਚੱਲਣੀ ਸੀ ਮਗਰ ਫਿਰਨ ਵਾਲੇ ਬੰਦੇ ਨੇ ਆਪਦੀ ਚਾਲ ਚੱਲਣੀ ਸੀ ਅਤੇ ਹੁਣ ਟਰੈਕਟਰ 'ਤੇ ਬੈਠੇ ਬਸ ਰੇਸ ਹੀ ਦੱਬਣੀ ਆ ਅਤੇ ਫਟਾਫਟ ਖੇਤ ਤਿਆਰ ਹੋ ਜਾਂਦਾ ਝੋਨਾ ਲੱਗ ਜਾਂਦਾ ਖੇਤੀ ਹੋ ਜਾਂਦੀ ਹੈ ਸਪਰੇ ਵਾਲੇ ਅੱਗੇ ਪੰਪ ਹੁੰਦੇ ਸੀ ਪੰਪ ਵੀ ਨਹੀਂ ਹੁੰਦੇ ਸੀ ਅਸੀਂ ਵੇਖਿਆ ਸਾਡੇ ਦਾਦੇ ਪੜਦਾਦੇ ਜੇ ਸੇਵਾ ਕਰਦੇ ਕਿਤੇ ਸਪਰੇ ਕਰਨ ਦੀ ਲੋੜ ਪੈਂਦੀ ਤਾਂ ਪੀਪਿਆਂ 'ਚ ਘੋਲ ਕਰਕੇ ਖੱਟੀ ਲੱਸੀ ਦਾ ਜਾਂ ਫਟਕੜੀ ਵਾਲੇ ਪਾਣੀ ਦਾ ਅਤੇ ਖਿੱਪਾਂ ਨਾਲ ਜਾਂ ਕੱਪੜਿਆਂ ਨਾਲ ਝਾੜ ਝਾੜ ਕੇ ਪਾਉਂਦੇ ਹੁਣ ਤਾਂ ਮਸ਼ੀਨਾਂ ਆ ਗਈਆਂ ਬਸ ਫਟਾਫਟ ਪੰਪ ਚੁੱਕੋ ਅਤੇ ਦਸ ਪੰਦਰ੍ਹਾਂ ਕਿੱਲੇ ਅਸੀਂ ਸਪਰੇ ਕਰ ਦਿਉ ਦਸ ਪੰਦਰ੍ਹਾਂ ਕਿੱਲੇ ਟਰੈਕਟਰਾਂ ਨਾਲ ਜ਼ਮੀਨ ਵਾਹ ਲਓ ਬਹੁਤ ਫਰਕ ਹੈ ਗਿੱਲੀ ਖੇਤੀ ਨਾਲੋਂ ਅਤੇ ਹੁਣ ਤਾਂ ਨਵੇਂ ਨਵੇਂ ਸੰਦ ਆ ਗਏ ਨਵੀਆਂ ਮਸ਼ੀਨਰੀਆਂ ਆ ਗਈਆਂ ਬਹੁਤ ਵਧੀਆ ਖੇਤੀ ਹੈ